ਭਾਰਤੀ ਨੌਕਰੀ ਬਜ਼ਾਰ ਜੇਕਰ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਹੈ ਇੱਕ ਤੋਂ ਇੱਕ ਭਾਰਤ ਦੇ ਵਿੱਚ ਨੌਕਰੀਆਂ ਦੇ ਸਕਿੱਲਸ ਐਨੇ ਜ਼ਿਆਦਾ ਹੈਗੇ ਨਾ ਕਿ ਬੜੇ ਬੇਰੁਜ਼ਗਾਰ ਵੀ ਕਈ ਫਿਰਦੇ ਪਏ ਨੇ ਨੌਕਰੀਆਂ ਇੰਨੀਆਂ ਨੇ ਕਿ ਜੇ ਇੱਕ ਨੂੰ ਆਪਾਂ ਜੇ ਕਿਸੇ ਨੂੰ ਕਿਸੇ ਨੂੰ ਇੱਕ ਨੂੰ ਤਨਖਾਹ ਮਿਲਦੀ ਹੈ ਘੱਟ ਤਾਂ ਉਸ ਤੋਂ ਉੱਪਰ ਵੀ ਉਹ ਤੋਂ ਉੱਪਰ ਵੀ ਉਹਨੂੰ ਵੱਧ ਕੇ ਦੇਣ ਵਾਲਾ ਕੋਈ ਹੈਗਾ ਵੈ ਕਿ ਉਹ ਮਤਲਬ ਕਿਸੇ ਤਰ੍ਹਾਂ ਬੰਦਾ ਸਾਡੇ ਕੋਲ ਆ ਜਾਵੇ ਫਿਰ ਇਹ ਵੀ ਆ ਕਿ ਜਿਹੜੀ ਭਾਰਤੀ ਜਿਹੜੀ ਨੌਕਰੀ ਆ ਉਹ ਜਿਹੜੀ ਆ ਕਈ ਤਾਂ ਇਹ ਵੀ ਇਹੋ ਜਿਹੇ ਵੀ ਵੇਖੇ ਜਾਂਦੇ ਹਨ ਕਈ ਇੰਨੇ ਕੁ ਜ਼ਿਆਦਾ ਬੇਰੁਜ਼ਗਾਰ ਹੈਗੇ ਆ ਨਾ ਕਿ ਉਹਨਾਂ ਨੂੰ ਉਹ ਨਸ਼ਿਆਂ ਦੇ ਵਿੱਚ ਜਾ ਰਹੇ ਹਨ ਨਸ਼ਿਆਂ ਦੇ ਵਿੱਚ ਜਾ ਰਹੇ ਹਨ ਨਸ਼ਿਆਂ 'ਚ ਜਾਣਗੇ ਆਪਣੀ ਜ਼ਿੰਦਗੀ ਖਰਾਬ ਕਰਨਗੇ ਇਹੀ ਜੇਕਰ ਉਹਨਾਂ ਨੂੰ ਸਰਕਾਰ ਨੌਕਰੀ ਦੀ ਘਰੇ ਉਹਨਾਂ ਦਾ ਰੁਜ਼ਗਾਰ ਦਾ ਸਾਧਨ ਬਣਾਏ ਅਤੇ ਇਹ ਵੈ ਕਿ ਉਹ ਨਸ਼ਿਆਂ ਤੋਂ ਬਚ ਸਕਦੇ ਹਨ ਭਾਰਤੀ ਨੌਕਰੀ ਬਜ਼ਾਰ ਦੇ ਵਿੱਚ ਤਾਂ ਦੇਖੋ ਇਹ ਵੀ ਆ ਕਿ ਜਿਹੜੀ ਜਿਹੜੀਆਂ ਬਾਰਾਂ ਬਾਰਾਂ ਘੰਟੇ ਕੰਮ ਕਰਵਾਇਆ ਜਾਂਦਾ ਅਤੇ ਤਨਖਾਹਾਂ ਕੁਛ ਵੀ ਨਹੀਂ ਭਰਦੇ ਤਨਖਾਹ ਘੱਟ ਹੋਣ ਕਰਕੇ ਉਹਨਾਂ ਦੇ ਪਰਿਵਾਰ ਦਾ ਪਰਿਵਾਰ ਦਾ ਜਿਹੜਾ ਹੈਗਾ ਵਾ ਆਪਣਾ ਰੋਜ਼ੀ ਰੋਟੀ ਨਹੀਂ ਚੱਲ ਪਾਉਂਦੀ ਉਹ ਭੁੱਖੇ ਮਰਦੇ ਹਨ ਅਤੇ ਲੜਾਈਆਂ ਝਗੜੇ ਹੁੰਦੇ ਹਨ ਫਿਰ ਘਰਾਂ ਦੇ ਵਿੱਚ ਫਿਰ ਬੰਦਾ ਇਨਸਾਨ ਜਿਹੜਾ ਵਾ ਉਹ ਨਸ਼ਿਆਂ ਦੇ ਵਿੱਚ ਚਲਾ ਜਾਂਦਾ ਹੈ ਅਤੇ ਇਸਦਾ ਇਹੀ ਆ ਕਿ ਜਿਹੜੀ ਮੌਜੂਦਾ ਜਿਹੜੀਆਂ ਇਹਦੀਆਂ ਚੁਣੌਤੀਆਂ ਇਹੀ ਹਨ ਕਿ ਇਹਨਾਂ ਦੀ ਜਿਹੜੀ ਹੈਗੀ ਆ ਇੱਕ ਤਾਂ ਨੌਕਰੀਆਂ ਵੱਧ ਤੋਂ ਵੱਧ ਪੈ ਕੀਤੀਆਂ ਜਾਣ ਅਤੇ ਇੱਕ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਹਨ ਉਹ ਥੋੜ੍ਹੀਆਂ ਜ਼ਿਆਦਾ ਹੋਣ ਤਾਂ ਕਿ ਉਹਨਾਂ ਦਾ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਹੋ ਸਕੇ